ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਮੇਰੇ ਪਿਤਾ ਜੀ ਨੇ ਸਾਨੂੰ ਇਕ ਵੀਡੀਓ ਗੇਮ ਲਿਆ ਕੇ ਦਿੱਤੀ ਜਿਸ ਦਾ ਸਾਨੂੰ ਦੇਖ ਕੇ ਚਾਅ ਨਾ ਚੱਕਿਆ ਜਾ ਅਸੀਂ ਦੋਨੇ ਭਰਾਵਾਂ ਨੇ ਰਾਤ ਰਾਤ ਭਰ ਵੀਡੀਓ ਗੇਮ 'ਤੇ ਲੱਗੇ ਰਹਿਣਾ ਅਤੇ ਉਸ ਦੇ ਨੂੰ ਹੀ ਖੇਡੀ ਜਾਣਾ ਉਦੋਂ ਇਹ ਚੀਜ਼ਾਂ ਬਹੁਤ ਘੱਟ ਸੀ ਸਾਨੂੰ ਇੰਝ ਲੱਗਿਆ ਵੀ ਸਾਨੂੰ ਪਤਾ ਹੀ ਨਹੀਂ ਕੀ ਮਿਲ ਗਿਆ ਅਸੀਂ ਸੌਂ ਸੌਣਾ ਖਾਣਾ ਈਵਨ ਕਿ ਪੜ੍ਹਨਾ ਵੀ ਭੁੱਲ ਗਏ ਅਸੀਂ ਉਸ 'ਤੇ ਹੀ ਲੱਗੇ ਰਹਿਣਾ ਘਰਦਿਆਂ ਦੀਆਂ ਝਿੜਕਾਂ ਵੀ ਪੈਣੀਆਂ ਤਾਂ ਵੀ ਅਸੀਂ ਅਣਜਾਣਾ ਕਰਕੇ ਉਸ 'ਤੇ ਵੀਡੀਓ ਗੇਮ ਖੇਡੀ ਜਾਣਾ ਸਾਨੂੰ ਦੁਨੀਆਂ ਦੀ ਸੁੱਧ ਬੁੱਧ ਹੀ ਭੁੱਲ ਗਈ ਅੱਜ ਵੀ ਅਕਸਰ ਅਸੀਂ ਉਹ ਦਿਨ ਯਾਦ ਕਰਦੇ ਹਾਂ ਤਾਂ ਉਹ ਐਕਸਪੀਰੀਅੰਸ ਸਾਡਾ ਬਹੁਤ ਵਧੀਆ ਰਿਹਾ ਅੱਜ ਦੀ ਦੁਨੀਆਂ ਵਿੱਚ ਭਾਵੇਂ ਇਹ ਚੀਜ਼ਾਂ ਆਮ ਨੇ ਹੁਣ ਬੱਚੇ ਜੰਮਦਿਆਂ ਦੇ ਹੱਥ ਮੋਬਾਈਲ ਨੇ ਅਤੇ ਮੋਬਾਇਲ ਦੇ ਉੱਪਰ ਹੀ ਉਹ ਵੀਡੀਓ ਗੇਮ ਖੇਡਦੇ ਹਨ ਪਰ ਅੱਜ ਤੋਂ ਪੱਚੀ ਤੀਹ ਸਾਲ ਪਹਿਲਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਨਹੀਂ ਸੀ ਉਦੋਂ ਵੀਡੀਓ ਗੇਮ ਹਰ ਇੱਕ ਕੋਲ ਨਹੀਂ ਸੀ ਸਾਨੂੰ ਵੀ ਇਹ ਇੱਦਾਂ ਲੱਗਿਆ ਜਿਵੇਂ ਸਾਨੂੰ ਕੋਈ ਅਲਾਦੀਨ ਦਾ ਚਿਰਾਗ ਮਿਲ ਗਿਆ ਹੋਵੇ ਅਸੀਂ ਦਿਨ ਰਾਤ ਵੀਡੀਓ ਗੇਮ 'ਤੇ ਹੀ ਲੱਗੇ ਰਹਿਣਾ ਸਾਨੂੰ ਬੜੀਆਂ ਝਿੜਕਾਂ ਮਿਲਦੀਆਂ ਕਈ ਵਾਰ ਅੱਖਾਂ ਦੁਖਣ ਲੱਗਦੀਆਂ ਤਾਂ ਅਸੀਂ ਵੀਡੀਓ ਗੇਮ ਖੇਡਦੇ ਖੇਡਦੇ ਹੀ ਟੀਵੀ ਅੱਗੇ ਸੌਂ ਜਾਣਾ ਫਿਰ ਉਸ ਤੋਂ ਬਾਅਦ ਸਾਡੇ ਸਾਡੇ ਘਰਦਿਆਂ ਨੇ ਸ਼ਿਕਾਇਤਾਂ ਸਕੂਲ ਦੇ ਵਿੱਚ ਲਗਾਈਆਂ ਸਾਨੂੰ ਅਧਿਆਪਕਾਂ ਦੀ ਝਾੜ ਪਾਈ ਫੇਰ ਅਸੀਂ ਵੀਡੀਓ ਗੇਮ ਖੇਡਣਾ ਘੱਟ ਕੀਤਾ